ਸਤਿ ਸ਼੍ਰੀ ਅਕਾਲ ਸਰ ਕੀ ਤੁਸੀਂ ਭੱਲਾ ਸਵੀਟਸ ਤੋਂ ਬੋਲਦੇ ਹੋ ਜੀ ਸਰ ਅਸੀਂ ਨਾ ਹੈ ਨਾ ਮੇਰੀ ਸਿਸਟਰ ਦੀ ਬਰਥਡੇ ਪਾਰਟੀ ਹੈ ਉਹਦੇ ਲਈ ਖਾਣਾ ਔਡਰ ਕਰਨਾ ਅਸੀਂ ਛੇ ਸੱਤ ਬੰਦਿਆਂ ਦਾ ਉਹਦੇ 'ਚ ਅਤੇ ਉਹਦੇ ਲਈ ਕੀ ਬਿੱਲ ਪੇ ਉਹ ਉਹ ਬਿੱਲ ਦੱਸ ਦਿਓ ਅਤੇ ਆਪਣੀ ਸਰਵਿਸ ਦੱਸ ਦਿਓ ਜੋ ਵੀ ਹੈ ਅਤੇ ਖਾਣੇ 'ਚ ਤੁਸੀਂ ਲਿਖ ਦਿਓ ਮਨਚੂਰੀਅਨ ਸਮੋਸਾ ਬਰਗਰ ਪੀਜ਼ਾ ਕੋਲਡ ਡਰਿੰਕ ਫਰੈਂਚ ਫਰਾਈਜ਼ ਜੀ ਬਸ ਸਰ ਇੰਨਾ ਹੀ ਹੈ ਅਤੇ ਹੈ ਨਾ ਇਹ ਸਭ ਨਾ ਸਾਨੂੰ ਅ ਕੱਲ ਸ਼ਾਮ ਨੂੰ ਚਾਰ ਵਜੇ ਤੱਕ ਘਰ ਪਹੁੰਚਾ ਦਿਓ ਐਡਰੈਸ ਹੈਗਾ ਮਕਾਨ ਨੰਬਰ ਤਿੰਨ ਸੌ ਪੰਜ ਗਲੀ ਨੰਬਰ ਦੋ ਜਿਲ੍ਹਾਂ ਫਤਿਹਗੜ੍ਹ ਸਾਹਿਬ ਪਿੰਡ ਮੰਡੋਫਲ ਥੈਂਕ ਯੂ ਸਰ